ਹੈਲੋ ਸਤਿ ਸ਼੍ਰੀ ਅਕਾਲ ਸਰ ਕੀ ਤੁਸੀਂ ਏ ਬੀ ਸੀ ਟਰੈਵਲ ਏਜੰਸੀ ਤੋਂ ਬੋਲ ਰਹੇ ਹੋ ਸਰ ਮੈਂ ਤੁਹਾਡਾ ਨੰਬਰ ਆਪਣੇ ਖ਼ਾਸ ਦੋਸਤ ਤੋਂ ਲਿਆ ਹੈ ਉਸਨੇ ਤੁਹਾਡੀ ਟਰੈਵਲ ਏਜੰਸੀ ਦੀ ਬਹੁਤ ਤਾਰੀਫ ਕੀਤੀ ਤਾਂ ਜੋ ਮੈਂ ਇਹ ਫੈਸਲਾ ਲਿਆ ਕਿ ਮੈਂ ਤੁਹਾਨੂੰ ਫੋਨ ਕਰਾਂ ਸਰ ਮੈਂ ਅਭਿਸ਼ੇਕ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੇਰੀ ਫੈਮਿਲੀ ਅਤੇ ਮੇਰੇ ਦੋਸਤ ਦਾ ਪਰਿਵਾਰ ਮਿਨੀ ਗੋਆ ਜੋ ਕਿ ਜੁਗਿਆਲ ਪਠਾਨਕੋਟ ਵਿੱਚ ਸਥਿੱਤ ਹੈ ਉੱਥੇ ਘੁੰਮਣ ਜਾਣ ਦਾ ਪਲੈਨ ਬਣਾ ਰਹੇ ਹਾਂ ਸਰ ਤੁਹਾਡੀ ਇੰਨੀ ਤਾਰੀਫ਼ ਸੁਣ ਕੇ ਮੈਂ ਤੁਹਾਡੀ ਹੀ ਟਰੈਵਲ ਏਜੰਸੀ ਨੂੰ ਹਾਇਰ ਕਰਨਾ ਚਾਹੁੰਦਾ ਹਾਂ ਸਰ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਕਿਰਾਏ ਦਾ ਕੀ ਹਿਸਾਬ ਕਿਤਾਬ ਹੈ ਅਸੀਂ ਦੋ ਇਨੋਵਾ ਗੱਡੀਆਂ ਲੈਣਾ ਚਾਹੁੰਨੇ ਹਾਂ ਤਾਂ ਜੋ ਸਾਡਾ ਪਰਿਵਾਰ ਖੁੱਲ੍ਹ ਕੇ ਬਿਨਾਂ ਕਿਸੀ ਤਕਲੀਫ ਦੇ ਉੱਥੇ ਘੁੰਮਣ ਜਾ ਸਕੇ ਨਾਲੇ ਤੁਸੀਂ ਪੈਸੇ ਦੇ ਖਰਚ ਬਾਰੇ ਵੀ ਦੱਸੋ ਕਿ ਤੁਸੀਂ ਕਿੰਨੇ ਪੈਸੇ ਲਓਗੇ ਅਤੇ ਉਸਦਾ ਹਿਸਾਬ ਕਿਤਾਬ ਦੱਸੋ ਕਿ ਤੁਸੀਂ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਲਓਗੇ ਜਾਂ ਪੂਰਾ ਆਣ ਜਾਣ ਦਾ ਪੈਸਾ ਲਓਗੇ ਅਤੇ ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਡਰਾਈਵਰਾਂ ਨੂੰ ਪੂਰਾ ਸਮਝਾ ਦਿੱਤਾ ਜਾਵੇ ਕਿ ਉਹਦੇ ਕੋਲ ਬੱਸਾਂ ਅਤੇ ਆਪਣੇ ਸਾਰੇ ਸਰਟੀਫਿਕੇਟ ਹੋਣ ਜਿਸ ਵਿੱਚ ਲਾਈਸੈਂਸ ਪਲਿਊਸ਼ਨ ਸਰਟੀਫਿਕੇਟ ਸਾਰੇ ਆਉਂਦੇ ਹਨ ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਪਰਸੋਂ ਦੇ ਦਿਨ ਤੀਹ ਮਾਰਚ ਨੂੰ ਸਾਨੂੰ ਤੁਹਾਡੀ ਗੱਡੀਆਂ ਚਾਹੀਦੀਆਂ ਹਨ ਅਤੇ ਸਾਢੇ ਅੱਠ ਵਜੇ ਸਵੇਰੇ ਚਾਹੀਦੀਆਂ ਹਨ ਸਾਨੂੰ ਤੁਹਾਡੀ ਫੋਨ ਦਾ ਉਡੀਕ ਰਹੇਗੀ ਧੰਨਵਾਦ